ਜੇ ਮੈਂ ਆਧੁਨਿਕ ਟੇਕਨਾਲੋਜੀ ਨਾਲ ਕਿਸੇ ਵੀ ਯੁਗ ਦੀ ਯਾਤਰਾ ਕਰ ਸਕਦਾ ਹਾਂ ਤਾਂ ਮੈਂ ਪੰਦਰ੍ਹਵੀਂ ਸਦੀ ਦੇ ਆਸ ਪਾਸ ਪੁਨਰ ਜਾਗਰਨ ਦੀ ਚੋਣ ਕਰਾਂਗਾ ਇਹ ਸਮਾਂ ਕਲਾ ਵਿਗਿਆਨ ਅਤੇ ਦਰਸ਼ਨ ਵਿੱਚ ਪੁਨਰ ਜਨਮ ਦਾ ਇੱਕ ਮਹੱਤਵਪੂਰਨ ਸਮਾਂ ਸੀ ਉੱਚ ਰੈਜੁਲਿਸ਼ਨ ਕੈਮਰਾ ਇੱਕ ਪੋਰਟੇਬਲ ਕੰਪਿਊਟਰ ਅਤੇ ਡਿਜੀਟਲ ਟੂਲ ਵਰਗੀਆਂ ਉੱਨਤ ਤਕਨਾਲੋਜੀਆਂ ਨੂੰ ਲਿਆਉਣਾ ਪਰਿਵਰਤਨਸ਼ੀਲ ਹੋਵੇਗਾ ਮੈਂ ਲਿਊਨਾਡੋ ਡੀ ਵਿਚੀ ਅਤੇ ਮਾਈਕਲ ਐਜਲੋ ਵਰਗੇ ਮਾਸਟਰਾਂ ਦੇ ਕੰਮਾਂ ਨੂੰ ਹਾਸਿਲ ਕਰਾਂਗਾ ਅਤੇ ਉਹਨਾਂ ਦਾ ਵਿਸ਼ਲੇਸ਼ਣ ਕਰਾਂਗਾ ਅਤੇ ਸੰਭਾਵੀ ਤੌਰ 'ਤੇ ਉਹਨਾਂ ਦੇ ਪ੍ਰੋਜੈਕਟਾਂ ਅਤੇ ਸਮਝ ਜਾਂ ਸਹਿਯੋਗ ਦੀ ਪੇਸ਼ਕਸ਼ ਕਰਾਂਗਾ ਉਹਨਾਂ ਦੀ ਪ੍ਰਤਿਭਾ ਬਾਰੇ ਸਾਡੀ ਸਮਝ ਨੂੰ ਵਧਾਵਾਂਗਾ ਉਸ ਯੁੱਗ ਤੋਂ ਟੇਕਨਾਲੋਜੀ ਦੇ ਸੰਬੰਧ ਵਿੱਚ ਮੈਂ ਮੁਢਲੇ ਪ੍ਰਿੰਟਿੰਗ ਪ੍ਰੈਸਾਂ ਨੂੰ ਮਿਟਾਉਣ ਬਾਰੇ ਸੋਚਾਂਗਾ ਜਦੋਂ ਕਿ ਉਹ ਕ੍ਰਾਂਤੀਕਾਰੀ ਸਨ ਉਹਨਾਂ ਦੇ ਸ਼ੁਰੂਆਤੀ ਸੰਸਕਰਨ ਸੰਪੂਰਨ ਤੋਂ ਦੂਰ ਸਨ ਅਤੇ ਅਕਸਰ ਗਲਤ ਜਾਣਕਾਰੀ ਅਤੇ ਗਿਆਨ ਤੱਕ ਸੀਮਿਤ ਪਹੁੰਚ ਵਿੱਚ ਯੋਗਦਾਨ ਪਾਉਂਦੇ ਸਨ ਇਹਨਾਂ ਸ਼ੁਰੂਆਤੀ ਮਸ਼ੀਨਾਂ ਵਿੱਚ ਸੁਧਾਰ ਕਰਕੇ ਜਾਂ ਵਿਸ਼ੇਸ਼ ਕੁਸ਼ਲ ਵਿਕਲਪ ਪ੍ਰਦਾਨ ਕਰਕੇ ਵਿਗਿਆਨ ਅਤੇ ਸਿੱਖਿਆ ਵਿੱਚ ਤੇਜ਼ੀ ਤਰੱਕੀ ਨੂੰ ਉਤਸ਼ਾਹਿਤ ਕਰਦੇ ਹੋਏ ਸਹੀ ਜਾਣਕਾਰੀ ਦੇ ਪ੍ਰਸਾਰ ਨੂੰ ਤੇਜ਼ ਕੀਤਾ ਜਾ ਸਕਦਾ ਹੈ ਸੰਖੇਪ ਰੂਪ ਵਿੱਚ ਪੁਨਰ ਜਾਗਰਨ ਦੀ ਚਤੁਰਾਈ ਨਾਲ ਆਧੁਨਿਕ ਤਕਨਾਲੋਜੀ ਨੂੰ ਜੋੜਨਾ ਸਾਡੇ ਇਤਿਹਾਸਿਕ ਗਿਆਨ ਵਿੱਚ ਪਾੜੇ ਨੂੰ ਪੂਰਾ ਕਰ ਸਕਦਾ ਹੈ ਅਤੇ ਮਨੁੱਖੀ ਤਰੱਕੀ ਵਿੱਚ ਯੁੱਗ ਦੇ ਯੋਗਦਾਨ ਦੀ ਇੱਕ ਭਰਪੂਰ ਸਮਝ ਨੂੰ ਵਧਾ ਸਕਦਾ ਹੈ